ਸਤਿ ਸ਼੍ਰੀ ਅਕਾਲ ਜੀ ਸਤਿਗੁਰੂ ਜੀ ਕੈਬ ਤੋਂ ਗੱਲ ਕਰ ਰਹੇ ਹੋ ਹਾਂਜੀ ਤੁਹਾਡੇ ਕੋਲੋਂ ਭਾਜੀ ਆਪਾਂ ਇੱਕ ਗੱਡੀ ਬੁੱਕ ਕਰਵਾਈ ਸੀ ਹਾਂਜੀ ਮੋਹਾਲੀ ਤੋਂ ਦਿੱਲੀ ਏਅਰਪੋਰਟ ਦੀ ਬਿਲਕੁਲ ਬਿਲਕੁਲ ਤੁਹਾਡਾ ਡਰਾਈਵਰ ਤੁਸੀਂ ਭੇਜਿਆ ਸੀ ਨਾ ਸਤਿਨਾਮ ਸਿੰਘ ਜੀ ਹਾਂਜੀ ਬਹੁਤ ਵਧੀਆ ਡਰਾਈਵਰ ਸੀ ਬਹੁਤ ਅੱਛਾ ਉਹਨੇ ਡਰਾਈਵ ਕੀਤਾ ਬੜਾ ਸਮੂਦਲੀ ਲੈ ਕੇ ਗਿਆ ਗੱਡੀ ਵਧੀਆ ਚਲਾਈ ਉਹਨੇ ਗੱਡੀ ਵੀ ਬੜੀ ਨੀਟ ਐਂਡ ਕਲੀਨ ਸੀ ਅਤੇ ਆਪਣਾ ਮਤਲਬ ਰਸਤੇ 'ਚ ਟ੍ਰੈਫ਼ਿਕ ਜਾਮ ਬਹੁਤ ਸੀ ਬਟ ਉਹ ਨੂੰ ਛੋਟੇ ਛੋਟੇ ਰਸਤੇ ਪਤਾ ਸੀ ਸਾਰੇ ਉਹਨੇ ਸ਼ੌਟਆਊਟਸ ਜਿਹੜੇ ਸੀ ਸ਼ਾਟਕੱਟ ਲੈ ਕੇ ਉਹਨੇ ਪੂਰੇ ਟਾਈਮ 'ਤੇ ਪਹੁੰਚਾ ਦਿੱਤਾ ਸੀ ਅਤੇ ਮਤਲਬ ਵਧੀਆ ਸੀ ਮੈਂ ਸਿਰਫ਼ ਉਹਦੀ ਤੁਹਾਨੂੰ ਫ਼ੀਡਬੈਕ ਹੀ ਦੇਣ ਵਾਸਤੇ ਕੋਲ ਕੀਤੀ ਹੈ ਕਿ ਬਹੁਤ ਅੱਛਾ ਡਰਾਈਵਰ ਸੀ ਅਤੇ ਬਹੁਤ ਹੀ ਫੈਮਿਲੀਅਰ ਜਿਹਾ ਸੀ ਟਾਈਮ ਨਾਲ਼ ਪਹੁੰਚਾਇਆ ਏ ਏਅਰਪੋਰਟ 'ਤੇ ਔਰ ਸਹੀ ਥਾਂ 'ਤੇ ਪਹੁੰਚਾਇਆ ਸਹੀ ਲੌਕੇਸ਼ਨ 'ਤੇ ਪਹੁੰਚਾਇਆ ਹੈ ਸਾਨੂੰ ਉੱਥੇ ਅ ਮਤਲਬ ਅੰਦਰ ਐਂਟਰ ਕਰਨ ਲਈ ਜ਼ਿਆਦਾ ਤੋਰਾ ਫੇਰਾ ਜਾਂ ਘੁੰਮਣ ਘੇਰੀ ਵਿੱਚ ਨਹੀਂ ਪਾਇਆ ਸਭ ਤੋਂ ਵਧੀਆ ਚੀਜ਼ ਆਹੀ ਸੀ ਕਿ ਉਹ ਜਿਹੜੇ ਉਹਨੂੰ ਸ਼ਾਟਕੱਟ ਪਤਾ ਸੀ ਉਹਨੇ ਸਾਰੇ ਯੂਜ਼ ਕੀਤੇ ਆ ਉਹ ਮਤਲਬ ਬਜਾਏ ਕਿ ਟ੍ਰੈਫ਼ਿਕ ਜਾਮ 'ਚ ਫਸਣ ਦੇ ਅਤੇ ਸਾਨੂੰ ਟਾਈਮ ਨਾਲ਼ ਪਹੁੰਚਾ ਦਿੱਤਾ ਸੀ ਹਾਂਜੀ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਅੱਗੋਂ ਵੀ ਕਰਾ ਕਰਾਵਾਂਗੇ ਕੈਬ ਬੁੱਕ ਤੁਹਾਡੇ ਕੋਲੋਂ ਹੀ ਓਕੇ